ਜੀ ਹਾਂ ਅੱਜ ਕੱਲ ਦੇ ਬੱਚਿਆਂ ਨੂੰ ਆਪਣਾ ਖਾਤਾ ਖਿਲਾਉਣਾ ਚਾਹੀਦਾ ਹੈ ਜਿਸ ਨਾਲ ਉਸ ਦੇ ਪੈਸਿਆਂ ਦੀ ਵੀ ਬੱਚਤ ਹੁੰਦੀ ਹੈ ਤੇ ਅੱਜ ਕੱਲ ਔਨਲਾਈਨ ਕੰਮ ਚੱਲਿਆ ਹੈ ਇੰਟਰਨੈਟ ਸੈਂਟਰ ਸਾਰਾ 'ਤੇ ਜਿਸ ਨਾਲ ਬੱਚਿਆਂ ਨੂੰ ਪੇਮੈਂਟ ਇੰਟਰਨੈਟ ਰਾਹੀਂ ਕਰਨੀ ਸੌਖੀ ਹੈ ਔਨਲਾਈਨ ਕਰਨੀ ਸੌਖੀ ਐ ਜਾਂ ਕਈ ਵਾਰੀ ਪੈਸੇ ਬੱਚੇ ਨਹੀਂ ਚੱਕਦੇ ਨਾਲ ਤੇ ਆਪਣਾ ਖਾਤਾ ਖਿਲਾਉਣਾ ਚਾਹੀਦਾ ਹੈ ਤੇ ਇੰਟਰਨੈਟ ਨਾਲ ਬਹੁਤ ਅੱਜ ਕੱਲ ਔਨਲਾਈਨ ਕੰਮ ਹੈ ਕਿਤੇ ਵੀ ਬੰਦਾ ਬਾਹਰ ਅੰਦਰ ਗਿਆ ਹੋਵੇ ਪੈਸੇ ਚੱਕਣ ਦੀ ਜਰੂਰਤ ਨਹੀਂ ਆਪਣੇ ਮੋਬਾਇਲ ਰਾਹੀਂ ਗੂਗਲ ਪੇ ਜਾ ਪੇ ਟੀ ਐਮ ਵਗੈਰਾ ਫੋਨ ਪੇ ਇਸ ਨਾਲੋਂ ਬਹੁਤ ਹੀ ਆਸਾਨ ਹੋ ਚੁੱਕਿਆ ਕੰਮ ਕਿਤੇ ਵੀ ਕੋਈ ਖਰੀਦਦਾਰੀ ਕਰਦੇ ਓ ਕਿਤੇ ਕਿਤੇ ਵੀ ਕੋਈ ਖਰੀਦਦਾਰੀ ਕਰਨੀ ਹੈ ਜਾਂ ਕੋਈ ਵੀ ਬੱਚਿਆਂ ਨੇ ਕੋਈ ਵੀ ਚੀਜ਼ ਲੈਣੀ ਹੈ ਤਾਂ ਇਸ ਕਰਕੇ ਅੱਜ ਕੱਲ ਬੱਚਿਆਂ ਨੂੰ ਖਾਤਾ ਖਿਲਾਉਣਾ ਚਾਹੀਦਾ ਹੈ ਇੰਟਰਨੈਟ ਦਾ ਬਹੁਤ ਹੀ ਸਾਨੂੰ ਅੱਜ ਕੱਲ ਫਾਇਦਾ ਹੋ ਰਿਹਾ ਹੈ ਤੇ ਇਸ ਕਰਕੇ ਬੱਚਿਆਂ ਨੂੰ ਬਹੁਤ ਜਰੂਰੀ ਹੈ ਅੱਜ ਕੱਲ ਦੇ ਬੱਚਿਆਂ ਨੂੰ ਖਾਤਾ ਖਿਲਾਉਣਾ ਚਾਹੀਦਾ ਹੈ ਔਨਲਾਈਨ ਪੇਮੈਂਟਾਂ ਕਰਨ 'ਚ ਆਸਾਨੀ ਹੋਵੇਗੀ ਗੂਗਲ ਪੇ ਜਿਵੇਂ ਜਿਸ ਤਰ੍ਹਾਂ ਵੀ ਤੇ ਨਾਲ ਬੱਚਿਆਂ ਨੂੰ ਪੈਸੇ ਬੱਚਤ ਕਰਨ ਲਈ ਵੀ ਸਿਕਸ਼ਾ ਦੇਣੀ ਚਾਹੀਦੀ ਹੈ ਕੀ ਆਪਣੇ ਪੈਸੇ ਵੱਧ ਤੋਂ ਵੱਧ ਆਪਣੇ ਪੈਸੇ ਬਚਾਉਣ 'ਤੇ ਜੋ ਕੀ ਅੱਗੇ ਜਾ ਕੇ ਉਹਨਾਂ ਦੇ ਕੰਮ ਨਾ ਸਕਣ ਸੀ